ਅਠਾਈ ਫਰਵਰੀ ਦੋ ਹਜ਼ਾਰ ਚਾਰ ਪੰਦਰਾਂ ਜੁਲਾਈ ਦੋ ਹਜ਼ਾਰ ਤਿੰਨ ਇੱਕ ਅਗਸਤ ਦੋ ਹਜ਼ਾਰ ਚਾਰ ਸੌਲਾਂ ਅਗਸਤ ਦੋ ਹਜ਼ਾਰ ਚਾਰ ਤੇਰ੍ਹਾਂ ਅਕਤੂਬਰ ਉੱਨੀ ਸੌ ਪਚਾਨਵੇਂ